ਕਹਿੰਦੇ ਨੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਲੱਕੜਾਂ ਦੀਆਂ ਚੱਪਲਾਂ ਪਾਉਂਦੇ ਸੀਗੇ ਜਾਂ ਜ਼ਿਆਦਾਤਰ ਕਹਿੰਦੇ ਪੰਜਾਬੀ ਜੁੱਤੀ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ ਪਰ ਮੈਂ ਹਮੇਸ਼ਾਂ ਚੱਪਲ ਜਾਂ ਜੁੱਤੀ ਦੇ ਵਿੱਚ ਹੀ ਪੈਰ ਨੂੰ ਰੱਖਦੀ ਹਾਂ ਕਿਉਂਕਿ ਅੱਡੀਆਂ ਫਟਣੀਆਂ ਮੈਨੂੰ ਵਧੀਆ ਨਹੀਂ ਲੱਗਦੀਆਂ ਹੈਗੀਆਂ ਇਹਦੇ ਨਾਲ ਕੀ ਆ ਕਿ ਪੈਰਾਂ ਦੀ ਜਿਹੜੀ ਦਿੱਖ ਆ ਉਹ ਖ਼ਰਾਬ ਹੋ ਜਾਂਦੀ ਆ ਇਸ ਕਰਕੇ ਮੈਂ ਜੁੱਤੀ ਜਾਂ ਚੱਪਲ ਅਤੇ ਚੱਪਲ ਹਮੇਸ਼ਾਂ ਪਾ ਕੇ ਰੱਖਦੀ ਹਾਂ ਅਤੇ ਰਹੀ ਕੱਪੜਿਆਂ ਦੀ ਗੱਲ ਮੇਰੇ ਕੋਲ ਕੋਈ ਖੇਡ ਕੱਪੜੇ ਨਹੀਂ ਹਨ ਮੈਂ ਝੂਠ ਨਹੀਂ ਬੋਲਾਂ ਮੇਰੇ ਕੋਲ ਕੋਈ ਖੇਡ ਕੱਪੜੇ ਨਹੀਂ ਹਨ ਮੇਰੇ ਕੋਲ ਜੇ ਕੋਈ ਪਹਿਰਾਵਾ ਹੈਗਾ ਵਾ ਮੈਂ ਘਰ ਜਿਨ੍ਹਾਂ ਦੇ ਵਿੱਚ ਆਰਾਮਦਾਇਕ ਫੀਲ ਕਰਦੀ ਹਾਂ ਉਹ ਆ ਮੇਰੇ ਸਲਵਾਰ ਸੂਟ ਸਲਵਾਰ ਸੂਟ ਮੇਰੇ ਕੋਲ ਬਥੇਰੇ ਨੇ ਮੈਂ ਉਹਨਾਂ ਦੇ ਵਿੱਚ ਆਰਾਮਦਾਇਕ ਫੀਲ ਕਰਦੀ ਹਾਂ ਵਧੀਆ ਲੱਗਦਾ ਏ ਮੈਨੂੰ ਇੱਕ ਐਂ ਵਾ ਕਿ ਸਾਡਾ ਪੰਜਾਬ ਦਾ ਪਹਿਰਾਵਾ ਹੀ ਪੰਜਾਬੀ ਸਲਵਾਰ ਸੂਟ ਆ ਮੇਰੇ ਕੋਲ ਹੋਰ ਘਘਰੇ ਵੀ ਹੈਗੇ ਨੇ ਪਰ ਉਹ ਕਿਤੇ ਕੋਈ ਵਿਆਹ ਸ਼ਾਦੀ ਹੋਵੇ ਉਹਨਾਂ ਦੇ ਵਿੱਚ ਮੈਂ ਪਾਉਂਦੀ ਹੁੰਦੀ ਹਾਂ ਖ਼ਾਸ ਕਰਕੇ ਮੇਰੇ ਕੋਲ ਹਰ ਇੱਕ ਤਰ੍ਹਾਂ ਦੇ ਸੂਟ ਨੇ ਹਲਕੇ ਤੋਂ ਹਲਕਾ ਵੀ ਆ ਭਾਰੇ ਤੋਂ ਭਾਰਾ ਵੀ ਆ ਵਧੀਆ ਸਵਾਉਂਦੀ ਹਾਂ ਕਿਉਂਕਿ ਮੈਨੂੰ ਸੂਟਾਂ ਦਾ ਚਾਅ ਵੀ ਆ ਬਹੁਤ ਸੂਟਾਂ ਦਾ ਚਾਅ ਵਾ ਉਹਨਾਂ ਨੂੰ ਕਈ ਕਈ ਤਰ੍ਹਾਂ ਦਾ ਬਣਵਾ ਕੇ ਮੈਂ ਪਾਉਂਦੀ ਜਿੱਦਾਂ ਅਫ਼ਗਾਨੀ ਸੂਟ ਹੋ ਗਈ ਪੰਜਾਬੀ ਸਲਵਾਰ ਸੂਟ ਹੋ ਗਿਆ ਪਟਿਆਲਾ ਸਲਵਾਰ ਸੂਟ ਹੋ ਗਿਆ ਛੋਟੇ ਪੌਂਚਿਆਂ ਨਾਲ ਮੈਂ ਹਰ ਇੱਕ ਤਰ੍ਹਾਂ ਦਾ ਕੱਪੜਾ ਪਾਇਆ ਵੀ ਆ ਪਾਉਂਦੀ ਵੀ ਹਾਂ ਪਰ ਮੈਂ ਜੇ ਕੁਛ ਚੀਜ਼ ਤੁਸੀਂ ਕਹੋ ਤਾਂ ਮੈਂ ਜ਼ਿਆਦਾਤਰ ਜਿਹੜੀ ਮੇਰੀ ਖੁਸ਼ੀ ਆ ਮੈਂ ਸਲਵਾਰ ਸੂਟ ਦੇ ਵਿੱਚ ਖੁਸ਼ ਹਾਂ ਮੈਨੂੰ ਆਰਾਮਦਾਇਕ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਅਗਰ ਮੈਂ ਸਫ਼ਰ ਸੁਫਰ ਵੀ ਕਰਦੀ ਹਾਂ ਕਿਤੇ ਆਉਂਦੀ ਹਾਂ ਜਾਂਦੀ ਹਾਂ ਤਾਂ ਸੂਟ ਹੀ ਪਾ ਕੇ ਜਾਂਦੀ ਹਾਂ ਕਿਤੇ ਘੁੰਮਣ ਫਿਰਨ ਵੀ ਜਾਵਾਂ ਤਾਂ ਵੀ ਸੂਟਾਂ ਦੇ ਵਿੱਚ ਹੀ ਜਾਂਦੀ ਹਾਂ ਮੈਨੂੰ ਬੱਚੇ ਬਹੁਤ ਕਹਿੰਦੇ ਨੇ ਕਿ ਮੰਮਾ ਤੁਸੀਂ ਜੀਨਸ ਪਾਇਆ ਕਰੋ ਜਾਂ ਕੋਈ ਹੋਰ ਡਰੈਸ ਪਾਇਆ ਕਰੋ ਪਰ ਮੈਨੂੰ ਵਧੀਆ ਹੀ ਸੂਟ ਲੱਗਦੇ ਆ ਹਾਂ ਵਿਆਹ ਸ਼ਾਦੀ ਹੋਵੇ ਕੋਈ ਤਿਉਹਾਰ ਹੋਵੇ ਤਾਂ ਮੈਂ ਸ਼ਰਾਰਾ ਗਰਾਰਾ ਜਾਂ ਮਤਲਬ ਪਲਾਜੋ ਪਲਾਜੋ ਤਾਂ ਮੈਂ ਪਾਉਂਦੀ ਨਹੀਂ ਕਿਉਂਕਿ ਮੈਨੂੰ ਵਧੀਆ ਨਹੀਂ ਲੱਗਦਾ ਨਾ ਪਜਾਮੀ ਵਧੀਆ ਲੱਗਦੀ ਹੈ ਮੈਂ ਸਲਵਾਰ ਸੂਟ 'ਚ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੀ ਹਾਂ ਵਧੀਆ ਲੱਗਦਾ ਮੈਨੂੰ ਮੈਂ ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਜਿਮ ਜੁਆਇਨ ਕੀਤਾ ਸੀ ਮੈਂ ਜਿਮ 'ਚ ਵੀ ਸਲਵਾਰ ਸੂਟ ਪਾ ਕੇ ਜਾਂਦੀ ਸੀ ਉੱਥੇ ਸਾਰੇ ਜਦੋਂ ਕਿ ਜਿਮ ਵਾਲੀ ਡਰੈਸ ਪਾਉਂਦੇ ਹੁੰਦੇ ਸੀਗੇ ਸਪੋਰਟਸ ਵਾਲੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਖੇਡ ਕੱਪੜੇ ਪਾਉਂਦੇ ਹੁੰਦੇ ਸੀਗੇ ਪਰ ਮੈਂ ਜਿੰਨੀ ਦੇਰ ਵੀ ਜਿਮ ਲਾਇਆ ਮੈਂ ਸਲਵਾਰ ਸੂਟ 'ਚ ਹੀ ਲਾਇਆ ਮੈਨੂੰ ਸਾਰਿਆਂ ਨੇ ਕਿਹਾ ਕਿ ਮੈਡਮ ਤੁਸੀਂ ਦੂਜੇ ਕੱਪੜੇ ਪਾ ਕੇ ਆਇਆ ਕਰੋ ਪਰ ਮੈਂ ਨਹੀਂ ਮੇਰਾ ਮਨ ਹੀ ਨਹੀਂ ਮੰਨਦਾ ਹੁੰਦਾ ਸੀਗਾ ਕਿਉਂਕਿ ਸਾਡਾ ਕਲਚਰ ਹੀ ਹੈ ਮੈਂ ਸਾਡਾ ਪਹਿਰਾਵਾ ਹੀ ਇਹ ਆ ਸਲਵਾਰ ਸੂਟ ਮੈਂ ਸਭ ਤੋਂ ਵੱਧ ਖੁਸ਼ ਹੀ ਸਲਵਾਰ ਸੂਟ ਦੇ ਵਿੱਚ ਹਾਂ ਮੈਂ ਜਿੰਨੀ ਦੇਰ ਵੀ ਛੇ ਸੱਤ ਮਹੀਨੇ ਜਿਹੜੇ ਜਿੰਮ 'ਚ ਲਾਏ ਨੇ ਉਹ ਸਲਵਾਰ ਸੂਟ ਦੇ ਵਿੱਚ ਹੀ ਲਾਏ ਨੇ ਸਾਰੇ ਦੇਖਦੇ ਹੁੰਦੇ ਸੀ ਪਰ ਮੈਂ ਕਦੇ ਫੀਲ ਨਹੀਂ ਕੀਤਾ ਕਿਉਂਕਿ ਮੈਨੂੰ ਮੈਂ ਲੋਕ ਲੋਕਾਂ ਨੂੰ ਬੁਰਾ ਲੱਗਦਾ ਹੋਵੇਗਾ ਪਰ ਮੈਨੂੰ ਆਪਣੇ ਆਪ 'ਚ ਕਦੇ ਬੁਰਾ ਨਹੀਂ ਲੱਗਾ ਮੈਂ ਹਮੇਸ਼ਾਂ ਖੁਸ਼ ਹਾਂ ਬਾਜ਼ਾਰ ਵੀ ਜਾਂਦੀ ਹਾਂ ਕਿਤੇ ਵੀ ਹਾਂ ਜਾਂਦੀ ਹਾਂ ਧਾਰਮਿਕ ਥਾਵਾਂ 'ਤੇ ਵੀ ਮੈਂ ਸੂਟ ਹੀ ਪਾ ਕੇ ਜਾਂਦੀ ਹਾਂ ਇੱਥੋਂ ਤੱਕ ਕਿ ਮੈਂ ਆਪਣੀ ਬੇਟੀ ਨੂੰ ਵੀ ਗੁਰਦੁਆਰੇ ਭੇਜਣਾ ਹੋਵੇ ਜਾਂ ਕਿਸੇ ਮੰਦਿਰ 'ਚ ਭੇਜਣਾ ਹੋਵੇ ਤਾਂ ਬੇਟੀ ਨੂੰ ਵੀ ਮੈਂ ਆਪਣੀ ਨੂੰ ਸਲਵਾਰ ਸੂਟ 'ਚ ਹੀ ਭੇਜਦੀ ਹਾਂ ਇਸ ਕਰਕੇ ਮੇਰਾ ਸਭ ਤੋਂ ਆਰਾਮਦਾਇਕ ਜਿਹੜਾ ਪਹਿਰਾਵਾ ਵਾ ਉਹ ਸਲਵਾਰ ਸੂਟ ਆ ਪੰਜਾਬ ਦਾ ਜਿਹੜਾ ਪਹਿਰਾਵਾ ਵਾ